ਹੈਲੋ ਹਾਂਜੀ ਹਾਂਜੀ ਤੁਸੀਂ ਕੌਣ ਮੈਮ ਵਧੀਆ ਮੈਮ ਤੁਸੀਂ ਦੱਸੋ ਹਾਂਜੀ ਹਾਂਜੀ ਹਾਂਜੀ ਤੁਸੀਂ ਕਮ ਕਮਲ ਹਾਂਜੀ ਹਾਂਜੀ ਤੁਸੀਂ ਕਮਲ ਤੋਂ ਨੰਬਰ ਲਿਆ ਸੀ ਨਾ ਮੈਨੂੰ ਦੱਸਿਆ ਸੀਗਾ ਉਹਨੇ ਵੀ ਹੈਲਪ ਕਰਦੀਂ ਮੈਂ ਮੈਮ ਇੱਥੇ ਵਧੀਆ ਸਕੂਲ ਕਾਫੀ ਹੈਗੇ ਜਿੱਦਾਂ ਕਿ ਇੱਕ ਤਾਂ ਉਹ ਹੀ ਹੋ ਗਿਆ ਇੱਕ ਤੁਸੀਂ ਸੁਣਿਆ ਐਮ ਐਨ ਸੀ ਸਕੂਲ ਹੈ ਐਮ ਐਨ ਸੀ ਐਮ ਐਨ ਸੀ ਮਤਲਬ ਕਾਫੀ ਵਧੀਆ ਸਕੂਲ ਹੈ ਉਹ ਉਹ ਕਿਆ ਕਹਿੰਦੇ ਹੁੰਦੇ ਆ ਮਤਲਬ ਹਾਂਜੀ ਨਹੀਂ ਹਾਂਜੀ ਟੋਪਲ ਸਕੂਲ ਹੈ ਇੱਥੇ ਨਾ ਮਤਲਬ ਜਿਹੜੇ ਸਕੂਲ ਆ ਨਾ ਇੱਥੇ ਕਿਆ ਕਹਿੰਦੇ ਹੁੰਦੇ ਆ ਈ ਈ ਸੈਕਸ਼ਨ ਤੱਕ ਸੈਕਸ਼ਨ ਹੈ ਮਤਲਬ ਇੱਕ ਕਲਾਸ ਦੇ ਈ ਸੈਕਸ਼ਨ ਮਤਲਬ ਕਾਫੀ ਬੱਚੇ ਪੜ੍ਹਦੇ ਇੱਥੇ ਹਾਂਜੀ ਕਾਫੀ ਵਧੀਆ ਸਕੂਲ ਹੈ ਇਹ ਵਾਲਾ ਵੀ ਸਟੱਡੀ ਵੀ ਕਾਫੀ ਵਧੀਆ ਹੈ ਨਾ ਇੱਥੇ ਅਤੇ ਤਾਂ ਬੱਚਿਆਂ ਦੀ ਐਕਟੀਵਿਟੀਜ਼ ਵਗੈਰਾ ਹੁੰਦੀਆਂ ਹੈ ਦਸ ਮੈਨੂੰ ਨਾ ਕਮਲ ਨੇ ਹੀ ਦੱਸਿਆ ਸੀਗਾ ਕਿ ਉਹਨੇ ਤੁਹਾਨੂੰ ਫੋਨ ਕਰਕੇ ਪੁੱਛਣਾ ਹੈ ਅਤੇ ਵੀ ਜਿੱਦਾਂ ਉਹ ਕਿਆ ਕਹਿੰਦੇ ਉਹਨੇ ਮੈਨੂੰ ਦੱਸਿਆ ਤਾ ਕਿ ਉਹਨੇ ਫੋਨ ਕਰਕੇ ਤੈਨੂੰ ਪੁੱਛਣਾ ਕਿ ਵੀ ਕਿਵੇਂ ਹੈ ਕਿਆ ਕਿਆ ਸਟੱਡੀਜ਼ ਹੈ ਕਿਆ ਐਕਟੀਵਿਟੀਜ਼ ਹੈ ਅਤੇ ਮੈਂ ਸਰਚ ਕੀਤਾ ਸੀਗਾ ਥੋੜ੍ਹਾ ਬਹੁਤ ਫਿਰ ਮੈਂ ਕਾਫੀ ਦੇਖਿਆ ਉਹਨਾਂ ਦੀ ਸਾਈਡ ਦੇ ਉੱਤੇ ਹੀ ਉਹਨਾਂ ਨੇ ਕਾਫੀ ਉਹ ਪਾਈਆਂ ਹੋਈਆਂ ਸੀਗੀਆਂ ਜਿੱਦਾਂ ਐਕਟੀਵਿਟੀਜ਼ ਕਰਵਾਉਂਦੇ ਬੱਚਿਆਂ ਨੂੰ ਬੱਚਿਆਂ ਨੂੰ ਪਲੇਅ ਗਰਾਉਂਡਸ ਹੈ ਐਕਟੀਵਿਟੀਜ਼ ਕਰਵਾਉਂਦੇ ਹੈ ਐਕਟੀਵਿਟੀ ਰੂਮਜ਼ ਹੈ ਮਤਲਬ ਕਾਫੀ ਮਤਲਬ ਪਲੇਅ ਜ਼ੋਨ ਜਿਹਾ ਬਣਾਇਆ ਵਾ ਉਹਨਾਂ ਨੇ ਬੱਚਿਆਂ ਵਾਸਤੇ ਕਾਫੀ ਵਧੀਆ ਹੈ ਮਤਲਬ ਉੱਥੇ ਦੇ ਮਤਲਬ ਮਾਰਕਸ ਵੀ ਵਧੀਆ ਆਉਂਦੇ ਬੱਚਿਆਂ ਦੇ ਟੋਪ ਕਰਦੇ ਬੱਚੇ ਹੋਰ ਇੱਕ ਸ਼ਿਵਾਲਿਕ ਸਕੂਲ ਹੋ ਗਿਆ ਉਹ ਵੀ ਵਧੀਆ ਹੈ ਸੈਨਿਕ ਸਕੂਲ ਹੋ ਗਿਆ ਸੈਨਿਕ ਸਕੂਲ ਵੀ ਕਾਫੀ ਮਤਲਬ ਮੰਨਿਆ ਵਾ ਸਕੂਲ ਹੈ ਉੱਥੇ ਵੀ ਕਾਫੀ ਬੱਚੇ ਪੜ੍ਹਦੇ ਆ ਸੈ ਬੋਰਡ ਮੈਮ ਇੱਕ ਨੂੰ ਮੈਂ ਕੰਨਫਰਮ ਕਰਕੇ ਪੁੱਛੁਗੀ ਮੈਨੂੰ ਹਜੇ ਕੰਨਫਰਮ ਨਹੀਂ ਮੈਂ ਕੰਨਫਰਮ ਕਰਕੇ ਦੱਸ ਦਊਂਗੀ ਤੁਹਾਨੂੰ ਵੈਸੇ ਟੋਪ ਦੇ ਸਕੂਲ ਹੈ ਟੀਚਰਸ ਵਧੀਆ ਮੈਂ ਸਾਰਾ ਚੈੱਕ ਕਰਕੇ ਮੈਨੂੰ ਕਮਲ ਨੇ ਦੱਸਿਆ ਸੀ ਨਾ ਜੀ ਵੀ ਕਿਹਨੂੰ ਤੁਹਾਨੂੰ ਫੋਨ ਕਰਕੇ ਪੁੱਛਣਾ ਤਾਂ ਮੈਂ ਕਾਫੀ ਸਰਚ ਕੀਤੀ ਸੀਗੀ ਮੈਨੂੰ ਵੀ ਨੋਲੇਜ ਨਹੀਂ ਹੈ ਵੈਸੇ ਵੀ ਵਧੀਆ ਕਿਹੜਾ ਹੈ ਵੈਸੇ ਜਿਹੜੇ ਆਹ ਸਕੂਲਾਂ ਹੈ ਨਾ ਸ਼ਿਵਾਲਿਕ ਔਰ ਆਹ ਸੈਨਿਕ ਸਕੂਲ ਇਹ ਵੀ ਕਾਫੀ ਵਧੀਆ ਮਤਲਬ ਇੱਥੇ ਸਾਡੇ ਮਤਲਬ ਆਂਡੀ ਗੁਆਂਢੀਆਂ ਦੇ ਬੱਚੇ ਵੀ ਪੜ੍ਹਦੇ ਆ ਇਹ ਵੀ ਕਾਫੀ ਵਧੀਆ ਸਕੂਲ ਹੈ ਮਤਲਬ ਇੱਥੇ ਵੀ ਕਾਫੀ ਮਤਲਬ ਜਿਹੜਾ ਸੈਨਿਕ ਸਕੂਲ ਹੈ ਇੱਥੇ ਬੱਚਿਆਂ ਨੂੰ ਮਤਲਬ ਬਹੁਤ ਜਿੱਦਾਂ ਗਰਾਊਂਡ ਵਗੈਰਾ ਗਰਾਉਂਡ ਫੈਸਿਲਟੀਜ਼ ਬਹੁਤ ਜ਼ਿਆਦਾ ਵਧੀਆ ਹੈ ਮਤਲਬ ਬੱਚਿਆਂ ਨੂੰ ਨਾ ਹੋਰ ਜਿੱਦਾਂ ਕਿ ਆਪਾਂ ਕੋਈ

ਹਾਂਜੀ ਹਾਂਜੀ ਹਾਂ ਐਕਸਟਰਾ ਕੋਚਿੰਗ ਇਹਨਾਂ 'ਚ ਜਦੋਂ ਬੱਚਿਆਂ ਨੂੰ ਸਕੂਲ ਤੇ ਬਾਹਰ ਟਿਊਸ਼ਨ ਵਗੈਰਾ ਰੱਖਣੀ ਹੋਵੇ ਟਿਊਸ਼ਨਸ ਵਗੈਰਾ ਦੀ ਫੈਸਿਲਟੀ ਵੀ ਹੈਗੀ ਹੈ ਹਾਂਜੀ ਔਰ ਇਹਨਾਂ ਦਾ ਪਲੇਅ ਜ਼ੋਨ ਹੈ ਜਿਹੜਾ ਸੈਨਿਕ ਵਾਲਿਆਂ ਦਾ ਗਰਾਊਂਡ ਹੈ ਉਹ ਕਾਫੀ ਵਧੀਆ ਹੈ ਮਤਲਬ ਗਰਾਊਂਡ ਬਹੁਤ ਵੱਡਾ ਬੱਚਿਆਂ ਦੇ ਲਈ ਹਾਂਜੀ ਬੱਚਿਆਂ ਦੇ ਲਈ ਗਰਾਊਂਡ ਵਗੈਰਾ ਹਾਂਜੀ ਹਾਂਜੀ ਠੀਕ ਹੈ ਹੁਣ ਓਕੇ ਹਾਂਜੀ ਕੋਈ ਨਹੀਂ ਮੈਮ ਇਟਸ ਓਕੇ